ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਾਂ ਪੁਰਾਣੇ ਜ਼ਮਾਨੇ ਦੇ ਕੇ ਕਿਚਨ ਵਿੱਚ ਬਹੁਤ ਫਰਕ ਹਨ ਪਹਿਲੇ ਜ਼ਮਾਨੇ ਦੀ ਕਿਚਨ ਵਿੱਚ ਚੌਲ ਬਣਾਉਣ ਵਾਸਤੇ ਰਾਈਸ ਕੂਕਰ ਅਤੇ ਮਸਾਲਾ ਕੁੱਟਣ ਵਾਸਤੇ ਮਿਕਸਚਰ ਅਤੇ ਓਵਨ ਪੀਜ਼ਾ ਬਣਾਉਣ ਵਾਸਤੇ ਓਵਨ ਇਸ ਤਰ੍ਹਾਂ ਦੀ ਬਿਜਲੀ ਦੀਆਂ ਜਿਹੜੀਆਂ ਵਸਤੂਆਂ ਹਨ ਉਹ ਨਹੀਂ ਸੀ ਹੁੰਦੀਆਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸਾਡੀ ਕਿਚਨ ਵਿੱਚ ਹਰ ਖਾਣੇ ਦੀ ਆਈਟਮ ਹਰ ਖਾਣੇ ਦੀ ਚੀਜ਼ ਨੂੰ ਬਣਾਉਣ ਲਈ ਵੱਖ ਵੱਖ ਤਰੀਕਿਆਂ ਨਾਲ ਮੌਜੂਦ ਹੈਗੀ ਹੈ ਜਿਵੇਂ ਕਿ ਜੇ ਤੁਸੀਂ ਕੁਝ ਗਰਮ ਕਰਨਾ ਹੈ ਤਾਂ ਤੁਸੀਂ ਓਵਨ ਯੂਜ ਕਰ ਸਕਦੇ ਹੋ ਜੇ ਤੂੰ ਵੀ ਤੁਸੀਂ ਕੁਝ ਬਣਾਉਣਾ ਹੈ ਅਤੇ ਤੁਸੀਂ ਮਾਈਕਰੋਵੇਵ ਯੂਜ ਕਰ ਸਕਦੇ ਹੋ ਜਿਵੇਂ ਖਾਣੇ ਦੀ ਆਈਟਮ ਪੀਜ਼ਾ ਹੋਗੀ ਜਾਂ ਫਿਰ ਕੁਛ ਹੋਰ ਹੋ ਗਈ ਅਤੇ ਉਹ ਤੁਸੀਂ ਗਰਿੱਲ ਕਰਨਾ ਕੁਝ ਅਤੇ ਤੁਸੀਂ ਮਾਈਕਰੋਵੇਵ ਯੂਜ ਕਰ ਸਕਦੇ ਹੋ ਜੇ ਤੁਸੀਂ ਮਸਾਲਾ ਕੁੱਟਣਾ ਤਾਂ ਬਿਜਲੀ ਦੀ ਤਾਰ ਨਾਲ ਜੁੜਿਆ ਹੋਇਆ ਇੱਕ ਮਿਕਸਰ ਗਰਾਂਈਡਰ ਯੁਜ ਯੂਜ਼ ਕਰ ਸਕਦੇ ਹੋ ਅਤੇ ਜਿਹੜੀ ਪਹਿਲੇ ਜ਼ਮਾਨੇ ਵਿੱਚ ਚੁੱਲ੍ਹਾ ਹੁੰਦਾ ਸੀਗਾ ਅੱਗ ਬਾਲ ਕੇ ਜਿਹਦੇ ਉੱਤੇ ਖਾਣਾ ਬਣਾਇਆ ਜਾਂਦਾ ਸੀਗਾ ਫਿਰ ਇਸ ਤੋਂ ਬਾਅਦ ਗੈਸ ਆ ਗਈ ਜਿਵੇਂ ਅਸੀਂ ਕਨੈਕਟ ਕਰਕੇ ਬਣਾਉਂਦੇ ਸੀਗੇ ਹੁਣ ਅੱਜ ਕੱਲ੍ਹ ਗੈਸ ਸਿਲੰਡਰ ਵੀ ਪਾਈਪਾਂ ਵਾਲੇ ਆ ਗਏ ਜਿਹਦੇ ਉੱਤੇ ਆਰਾਮ ਨਾਲ ਅਸੀਂ ਆਪਣੀ ਕਿਚਨ ਵਿੱਚ ਖਾਣਾ ਬਣਾ ਸਕਦੇ ਹਾਂ